ਹੈਲੋ ਹਾਂਜੀ ਗੋਪਾਲ ਸਵੀਟਸ ਤੋਂ ਬੋਲ ਰਹੇ ਹੋ ਜੀ ਹਾਂਜੀ ਮੈਂ ਕੁਝ ਮਿਠਾਈਆਂ ਮੰਗਵਾਉਣੀਆਂ ਸੀ ਤੁਹਾਡੀ ਮਠਿਆਈ ਬਹੁਤ ਵਧੀਆ ਹੁੰਦੀ ਹੈ ਇਸ ਕਰਕੇ ਮੈਂ ਤੁਹਾਨੂੰ ਔਡਰ ਕਰ ਰਿਹਾ ਤੁਸੀਂ ਸ ਸਾਨੂੰ ਇੱਕ ਹਲਵਾ ਇੱਕ ਕਿੱਲੋ ਹਲਵਾ ਭੇਜ ਦਿਓ ਜੀ ਤੁਹਾਡੇ ਆਈਸਕ੍ਰੀਮ ਹੈ ਜੀ

ਜੇ ਆਈਸਕਰੀਮ ਹੈ ਤਾਂ ਆਈਸਕਰੀਮ ਦਾ ਵੀ ਇੱਕ ਔਡਰ ਤੁਹਾਨੂੰ ਕਰਨਾ ਇੱਕ ਪੈਕੇਟ ਆਈਸਕਰੀਮ ਦਾ ਭੇਜ ਦਿਓ ਇਸ ਤੋਂ ਇਲਾਵਾ ਹੋਰ ਤੁਹਾਡੇ ਕੋਲ ਕੀ ਕੀ ਹੈ ਜੀ ਅੱਛਾ ਜੀ ਅਤੇ ਤੁਸੀਂ ਇੱਕ ਕੇਕ ਦਾ ਵੀ ਕੇਕ ਵੀ ਲਿਖ ਲਵੋ ਉਸ ਤੋਂ ਇਲਾਵਾ ਨਾਲ ਨਾਲ ਉਹਦੇ ਰਸ ਭਰੀਆਂ ਵੀ ਲਿਖ ਦਿਓ ਹਾਂਜੀ ਸਾਡੇ ਰਿਸ਼ਤੇਦਾਰ ਵੀ ਆਏ ਹੋਏ ਨੇ ਤੁਹਾਡੀ ਮਠਿਆਈ ਦੀ ਬੜੀ ਤਾਰੀਫ਼ ਕਰਦੇ ਨੇ ਸੋ ਕਿਰਪਾ ਕਰਕੇ ਜਲਦੀ ਤੋਂ ਜਲਦੀ ਭੇਜ ਦਿਓ ਪੇਮੈਂਟ ਕਿਵੇਂ ਕਰਨੀ ਹੈ ਜੀ ਕੈਸ਼ ਕਰਨਾ ਹੈ ਜਾਂ ਔਨਲਾਈਨ ਕਰਨਾ ਤੁਸੀਂ ਔਨਲਾਈਨ ਹੀ ਰੱਖੋ ਜੀ ਅਤੇ ਮੈਂ ਤੁਹਾਨੂੰ ਔਨਲਾਈਨ ਪ ਪੇਮੈਂਟ ਕਰ ਰਿਹਾਂ ਤੋਂ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਔਡਰ ਕਰ ਦਿਓ ਔਡਰ ਭੇਜ ਦਿਓ ਜੀ